ਖਾਣਾ ਪਕਾਉਣਾ ਕਈਆਂ ਔਰਤਾਂ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਜਿਸ ਦੀ ਦਿਲਚਸਪੀ ਜਿਸ ਕੰਮ ਵਿੱਚ ਹੁੰਦੀ ਹੈ ਉਹ ਕੰਮ ਬਹੁਤ ਹੀ ਵਧੀਆ ਢੰਗ ਨਾਲ ਕਰਦੀਆਂ ਹਨ ਮੇਰੀਆਂ ਭੈਣਾਂ ਦੀ ਦਿਲਚਸਪੀ ਜ਼ਿਆਦਾਤਰ ਖਾਣਾ ਬਣਾਉਣ ਵਿੱਚ ਹੈ ਅਤੇ ਉਹ ਬ ਖਾਣਾ ਬਹੁਤ ਹੀ ਵਧੀਆ ਅਤੇ ਟੇਸਟੀ ਬਣਾਉਂਦੀਆਂ ਨੇ ਪਰ ਮੈਨੂੰ ਇਹ ਕੰਮ ਕਰਨਾ ਦੁਨੀਆਂ ਦਾ ਸਭ ਤੋਂ ਔਖਾ ਲੱਗਦਾ ਹੈ ਕਿਉਂਕਿ ਮੈਨੂੰ ਖਾਣਾ ਪਕਾਉਣਾ ਨਹੀਂ ਆਉਂਦਾ ਮੈਂ ਜ਼ਿਆਦਾ ਪੜ੍ਹਾਈ ਵਿੱਚ ਹੀ ਦਿਲਚਸਪੀ ਰੱਖਦੀ ਹਾਂ ਅਤੇ ਮੇਰਾ ਖਾਣਾ ਬਣਾਉਣ ਵਿੱਚ ਦਿਲਚਸਪੀ ਨਹੀਂ ਹੈ ਮੈਨੂੰ ਰਸੋਈ ਵਿੱਚ ਪਿਆਜ ਕੱਟਣ ਵੇਲੇ ਹੰਝੂ ਅੱਖਾਂ 'ਚੋਂ ਪਾਣੀ ਅਤੇ ਬਹੁਤ ਹੀ ਮ ਮੁਸ਼ਕਿਲ ਆਉਂਦੀ ਆਟਾ ਗੁੰਨਣ ਵੇਲੇ ਗੁੰਨਣ ਵੇਲੇ ਮੇਰੀਆਂ ਮੇਰੇ ਵਾਲ ਨੇ ਜੋ ਉਹ ਆਟੇ ਵਿਚ ਚਲੇ ਜਾਂਦੇ ਹਨ ਅਤੇ ਜਿਸ ਕਾਰਨ ਘਰ ਦੇ ਵਿੱਚ ਆਫਤ ਆ ਜਾਂਦੀ ਹੈ ਘਰ ਦੇ ਹੀ ਗਾਲ੍ਹਾਂ ਕਰਦੇ ਨੇ ਕਿ ਇਸ ਨੂੰ ਕੁਕਿੰਗ ਕਰਨੀ ਨਹੀਂ ਆਉਂਦੀ ਕੁਕਿੰਗ ਕਰਨ ਨਾਲ ਮੈਨੂੰ ਬਹੁਤ ਹੀ ਘਟੀਆ ਮਹਿਸੂਸ ਹੁੰਦਾ ਹੈ ਕੁਕਿੰਗ ਮੇਰੇ ਲਈ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ